ਮੈਂ ਇੱਕ ਘਰੇਲੂ ਜਿਹੜੀ ਹੈਗੀ ਔਰਤ ਹਾਂ ਔਰ ਘਰ ਵਿੱਚ ਬਹੁਤ ਸਾਰੀਆਂ ਕਈ ਵਾਰੀ ਇਹੋ ਜਿਹੀ ਆਪਣੀ ਕਿਚਨ ਵਿੱਚ ਰਸੋਈ ਵਿੱਚ ਸਮਾਨ ਬਚ ਜਾਂਦਾ ਜਿਨ੍ਹਾਂ ਦੀ ਵਰਤੋਂ ਆਪਾਂ ਕਰੀਏ ਤਾਂ ਜ਼ਿਆਦਾ ਚੰਗੀ ਗੱਲ ਹੈ ਉਹਨੂੰ ਸੁੱਟਣ ਦੀ ਬਜਾਏ ਜਿਸ ਤਰ੍ਹਾਂ ਕਿ ਆਪਣਾ ਰੋਟੀਆਂ ਨੇ ਰੋਟੀਆਂ ਨੂੰ ਆਪਾਂ ਕਈ ਵਾਰੀ ਰਾਤ ਨੂੰ ਬਚ ਜਾਂਦੀਆਂ ਸਵੇਰੇ ਉਹਨੂੰ ਜਿਹੜਾ ਹੈਗਾ ਤੁਸੀਂ ਚੂਰੀ ਕੁੱਟ ਕੇ ਉਹਦੇ ਵਿੱਚ ਖਾਓ ਤਾਂ ਕਿਆ ਨਜ਼ਾਰਾ ਆਉਂਦਾ ਦੇਸੀ ਘੀ ਬਣਾ ਕੇ ਖਾਓ ਤਾਂ ਬੜਾ ਮਜ਼ਾ ਆਉਂਦਾ ਦਾਲ ਬਚ ਜਾਂਦੀ ਹੈ ਦਾਲ ਨੂੰ ਆਪਾਂ ਆਟੇ ਵਿੱਚ ਗੁੰਨ ਲਉ ਹੈ ਨਾ ਇਹ ਚੀਜ਼ਾਂ ਬੜੀਆਂ ਚੰਗੀਆਂ ਹੁੰਦੀਆਂ ਨੇ ਖਾਣ 'ਚ ਵੀ ਬੜੀਆਂ ਚੰਗੀਆਂ ਲੱਗਦੀਆਂ ਬੜੇ ਹਰ ਕੋਈ ਪਸੰਦ ਕਰਕੇ ਖਾਂਦਾ ਹੈ ਅਤੇ ਜੇ ਇਸ ਚੀਜ਼ ਦੀ ਗੱਲ ਕਰੀ ਜਾਵੇ ਪ੍ਰੇਰਿਤ ਕਿਵੇਂ ਹੋਏ ਹਾਂ ਆਪਾਂ ਇਹ ਇਹੀ ਚੀਜ਼ ਹੈ ਕਿ ਆਪਾਂ ਵੇਸਟ ਨਾ ਕਰੀਏ ਬਹੁਤ ਸਾਰੇ ਇਹੋ ਜਿਹੇ ਗਰੀਬ ਹੈ ਜਿਨ੍ਹਾਂ ਨੂੰ ਖਾਣ ਨੂੰ ਵੀ ਨਹੀਂ ਮਿਲਦਾ ਇਸ ਲਈ ਆਪਾਂ ਸੁੱਟਣ ਦੀ ਬਜਾਏ ਉਹਨੂੰ ਵਰਤੋਂ ਵਿੱਚ ਲੈ ਕੇ ਉਹਨੂੰ ਸਹੀ ਢੰਗ ਨਾਲ਼ ਉਹਨਾਂ ਨੂੰ ਚੁਣੀਏ ਵੀ ਕਿਵੇਂ ਬਣਾਇਆ ਜਾਵੇ ਅਤੇ ਉਹਨੂੰ ਖਾਇਆ ਜਾਵੇ ਖਰ ਬਰਬਾਦੀ ਨਾ ਕੀਤੀ ਜਾਵੇ ਉਹਨੂੰ ਆਪਣਾ ਚ ਸਹੀ ਢੰਗ ਨਾਲ਼ ਵਰਤਿਆ ਜਾਵੇ